ਸਾਡਾ ਜਿਹੜਾ ਡੇਲੀ ਲਾਈਫ ਸਟਾਈਲ ਹੈ ਉਹ ਇ ਚੇਂ ਇੱਕ ਤਰ੍ਹਾਂ ਚੇਂਜ ਹੋ ਗਿਆ ਸਾਡਾ ਖਾਣਾ ਪੀਣਾ ਉੱਠਣਾ ਬੈਠਣਾ ਬਹੁਤ ਚੇਂਜ ਹੋ ਗਿਆ ਖਾਣ ਪੀਣ ਦੀਆਂ ਚੀਜ਼ਾਂ 'ਚ ਬਹੁਤ ਮਿਲਾਵਟ ਮਿਲਦੀ ਹੈ ਅੱਜ ਕੱਲ੍ਹ ਸਾਡਾ ਉੱਠਣਾ ਬੈਠਣਾ ਵੀ ਸਹੀ ਨਹੀਂ ਹੈਗਾ ਅਤੇ ਸਾਡੇ ਜਿਹੜੇ ਬਹੁਤ ਸਨ ਜਿਹੜਾ ਬੋਡੀ ਪੋਸਚਰ ਹੈ ਜਦੋਂ ਆਪਾਂ ਬੈਠਦੇ ਹਾਂ ਉਹ ਬਹੁਤ ਮਤਲਬ ਚੇਂਜ ਹੁੰਦਾ ਅਤੇ ਫਿਰ ਅੱਜ ਕੱਲ੍ਹ ਅੱਜ ਕੱਲ੍ਹ ਲੋਕਾਂ ਦਾ ਸ਼ ਸ਼ਡਿਊਲ ਐਨਾ ਬਿਜ਼ੀ ਚਲ ਮਤਲਬ ਬਿਜ਼ੀ ਚੱਲਦਾ ਸਾਡਾ ਸ਼ਡਿਊਲ ਸਾਡੇ ਕੰਮਾਂ ਕਰਕੇ ਕੁਛ ਸਟੱਡੀ ਕਰਕੇ ਬੱਚਿਆਂ ਦੀ ਕਰਕੇ ਉਹਦੇ ਕਰਕੇ ਫਿਰ ਹੁਣ ਸਾਨੂੰ ਐਕਸਸਾਈਜ ਕਰਨ ਲਈ ਵੀ ਟਾਈਮ ਨਹੀਂ ਮਿਲਦਾ ਜਿਹਦੇ ਕਰਕੇ ਬਿਜ਼ੀ ਸ਼ਡਿਊਲ ਕਰਕੇ ਅਸੀਂ ਆਪਣੇ ਸਿਹਤ 'ਤੇ ਧਿਆਨ ਨਹੀਂ ਦਿੰਦੇ ਜਿਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਅਤੇ ਮੁਸ਼ਕਲਾਂ ਲੱਗ ਮੁਸ਼ਕਲਾਂ ਆਉਂਦੀਆਂ ਹੈ ਅਤੇ ਉਹਨਾਂ 'ਚੋਂ ਇੱਕ ਪਿੱਠ ਦਾ ਦਰਦ ਪਿੱਠ ਦੇ ਦਰ ਪਿੱਠ ਦਾ ਦਰਦ ਹਰ ਇੱਕ ਏਜ ਏਜ ਨੂੰ ਹੈਗਾ ਜਿਵੇਂ ਛੋਟੇ ਬੱਚੇ ਨੂੰ ਬਜ਼ੁਰਗਾਂ ਨੂੰ ਹਰ ਇੱਕ ਨੂੰ ਹੁਣ ਤਾਂ ਹਰ ਇੱਕ ਆਮ ਹੁਣ ਤਾਂ ਹਰ ਇੱਕ ਨੂੰ ਪਿੱਠ ਦਾ ਦਰਦ ਹੁੰਦਾ ਹੈ ਅਤੇ ਪਿੱਠ ਦੇ ਦਰਦ ਠੀਕ ਕਰਨ ਲਈ ਬਹੁਤ ਸਾਰੇ ਘਰੇਲੂ ਨੁਸਖੇ ਹਨ ਸਾਡੇ ਪਿੰਡ ਵਿੱਚ ਪੇਂਡੂ ਭਾਸ਼ਾ ਵਿੱਚ ਇੱਕ ਤਰ੍ਹਾਂ ਕਿਹਾ ਜਾਂਦਾ ਕੰਡਾ ਕੱਢਣਾ ਉਸ ਬੰ ਜਿਸ ਬੰਦੇ ਦੀ ਪਿੱਠ 'ਚ ਦਰਦ ਹੁੰਦਾ ਉਹਦੇ ਉਹਦੀ ਪਿੱਠ 'ਤੇ ਦੂਜਾ ਬੰਦਾ ਚੜ੍ਹ ਕੇ ਮਤਲਬ ਉਹਨੂੰ ਖੜ੍ਹਾ ਹੋ ਕੇ ਮਤਲਬ ਉਹਦਾ ਉਹਦੀ ਪਿੱਠ ਦੀ ਸਹੀ ਕਰਨ ਪਿੱਠ ਦਾ ਕੰਡਾ ਕੱਢਦਾ ਹੈ ਜਾਂ ਫਿਰ ਪਿੱਠ ਦੀ ਮਾਲਿਸ਼ ਕਰਨੀ ਜਾਂ ਫਿਰ ਇਹ ਤਾਂ ਇੱਕ ਸਾਡਾ ਜਿਹੜਾ ਪਿੰਡ ਹੈ ਇਹ ਜੰਗਲੀ ਏਰੀਏ 'ਚ ਹੈ ਅਤੇ ਇੱਥੇ ਬਹੁਤ ਸਾਰੀਆਂ ਜੜ੍ਹੀ ਬੂਟੀਆਂ ਮਿਲਦੀਆਂ ਹੈ ਅਤੇ ਇਹਨਾਂ ਜੜ੍ਹੀ ਬੂਟੀਆਂ ਇਹਨਾਂ ਜੜ੍ਹੀ ਬੂਟੀਆਂ ਦੀ ਦਵਾਈ ਤਿਆਰ ਕੀਤੀ ਜਾਂਦੀ ਹੈ ਅਤੇ ਜਿਹੜੀ ਪਿੱਠ ਦੇ ਦਰਦ ਲਈ ਬਹੁਤ ਵਧੀਆ ਹੁੰਦੀ ਹੈ